ਖੇਡਾਂ ਆਮ ਬੰਦੇ ਦੀ ਜ਼ਿੰਦਗੀ ਦਾ ਬਹੁਤ ਅਹਿਮ ਪਹਿਲੂ ਹੈ ਖੇਡਾਂ ਨਾ ਸਿਰਫ ਬੰਦੇ ਨੂੰ ਕੋਈ ਜੀਵਨ ਵਿੱਚ ਕੰਮ ਸਿਖਾਉਂਦੀ ਹੈ ਬਲਕਿ ਇਹ ਜੀਵਨ ਜੀਣ ਦਾ ਤਰੀਕਾ ਵੀ ਸਿਖਾਉਂਦੀ ਹੈ ਅੱਜ ਕੱਲ੍ਹ ਦੇ ਸਮੇਂ ਵਿੱਚ ਬੰਦੇ ਲਈ ਸਿਰਫ ਪੜ੍ਹਾਈ ਲਿਖਾਈ ਹੀ ਸਭ ਕੁਛ ਨਹੀਂ ਹੈ ਖੇਡਾਂ ਬਹੁਤ ਅਹਿਮ ਹਿੱਸਾ ਰੱਖਦੀਆਂ ਹਨ ਖੇਡਾਂ ਨਾ ਸਿਰਫ ਸਰੀਰ ਰੂਪ 'ਤੇ ਬੰਦੇ ਨੂੰ ਤਿਆਰ ਕਰਦੀਆਂ ਹਨ ਮਾਨਸਿਕ ਰੂਪ 'ਤੇ ਵੀ ਬਹੁਤ ਤਿਆਰ ਕਰਦੀਆਂ ਹਨ ਖੇਡਾਂ ਸਾਨੂੰ ਸਿਖਾਉਂਦੀਆਂ ਹਨ ਕਿ ਜਦੋਂ ਸਾਡੇ ਜੀਵਨ ਵਿੱਚ ਕੋਈ ਮੁਸ਼ਕਲ ਸਮਾਂ ਆਏ ਤਾਂ ਅਸੀਂ ਉਸ ਤੋਂ ਕਿੱਦਾਂ ਉੱਭਰ ਸਕਦੇ ਹਾਂ ਅਤੇ ਉਹਨੂੰ ਅਸੀਂ ਸੁਲਝਾ ਸਕਦੇ ਹਾਂ ਕੋਈ ਵੀ ਮੁਸ਼ਕਲ ਸੁਲਝਾਉਣੀ ਹੋਵੇ ਤਾਂ ਸਾਨੂੰ ਉਸਨੂੰ ਡੱਟ ਕੇ ਸਾਹਮਣਾ ਕਰਨਾ ਪੈਂਦਾ ਹੈ ਅਤੇ ਖੇਡਾਂ ਹਮੇਸ਼ਾ ਸਾਨੂੰ ਇਹੀ ਚੀਜ਼ ਸਿਖਾਉਂਦੀਆਂ ਹਨ ਖੇਡਾਂ ਹਮੇਸ਼ਾ ਸਿਖਾਉਂਦੀਆਂ ਹਨ ਕਿ ਕਿੱਦਾਂ ਤਿੰਨ ਚਾਰ ਬੰਦੇ ਜਾਂ ਉਸ ਤੋਂ ਵੱਧ ਬੰਦੇ ਮਿਲ ਕੇ ਇੱਕ ਦੂਜੇ ਦਾ ਸਾਥ ਦੇ ਕੇ ਕਿਸੇ ਚੀਜ਼ ਨਾਲ ਲੜ ਸਕਦੇ ਹਨ ਅਤੇ ਕਿਸੇ ਚੀਜ਼ ਤੋਂ ਉੱਭਰ ਸਕਦੇ ਹਨ ਖੇਡਾਂ ਬੰਦੇ ਨੂੰ ਜਿਸ ਤੋਂ ਨਸ਼ੇ ਤੋਂ ਦੂਰ ਰੱਖਦੀਆਂ ਹਨ ਉਸ ਤਰ੍ਹਾਂ ਖੇਡਾਂ ਬੰਦੇ ਨੂੰ ਜੀਵਨ ਵਿੱਚ ਹਮੇਸ਼ਾ ਅੱਗੇ ਵਧਾਉਂਦੇ ਰਹਿਣ ਲਈ ਵੀ ਉਹਨੂੰ ਬਹੁਤ ਪ੍ਰੋਤਸ਼ਾਹਿਤ ਕਰਦੀਆਂ ਹਨ ਖੇਡਾਂ ਹਮੇਸ਼ਾ ਬੰਦੇ ਨੂੰ ਸਿਖਾਉਂਦੀਆਂ ਹਨ ਕਿ ਕਦੇ ਵੀ ਉਹ ਪਿੱਛੇ ਛੁੱਟ ਕੇ ਵੀ ਅੱਗੇ ਨਿਕਲ ਸਕਦਾ ਹੈ ਔਰ ਜੀਵਨ ਵਿੱਚ ਕਿਸੇ ਤੋਂ ਘੱਟ ਨਹੀਂ ਹੈ ਅਤੇ ਉਹ ਜੀਵਨ ਵਿੱਚ ਕੁਛ ਵੀ ਚਾਹੇ ਤਾਂ ਕੁਛ ਵੀ ਪਾ ਸਕਦਾ ਆਪਣੀ ਮਿਹਨਤ ਤੋਂ